ਹਾਂਜੀ ਸਾਡੀ ਮੰਜ਼ਿਲ ਤੈਰਾਕੀ ਦੀ ਝੀਲ ਹੈ ਕਿਉਂ ਕਰਕੇ ਮੈਨੂੰ ਝੀਲ ਵਿੱਚ ਤੈਰਨਾ ਬਹੁਤ ਪਸੰਦ ਹੈ ਕਈ ਵਾਰ ਮੌਕਾ ਮਿਲਿਆ ਦੂਰ ਕਿਤੇ ਗਏ ਉੱਥੇ ਝੀਲ 'ਚ ਤੈਰਨ ਦਾ ਅਤੇ ਹੋਰ ਚੀਜ਼ਾਂ ਤੋਂ ਝੀਲ ਮੈਨੂੰ ਬਹੁਤ ਜ਼ਿਆਦਾ ਪਸੰਦ ਹੈ ਅਤੇ ਸਾਡੇ ਨੇੜੇ ਨਹਿਰ ਵੱਗਦੀ ਹੈ ਜਿਸ ਤੋਂ ਛੋਟਾ ਸੂਆ ਨਿਕਲਦਾ ਹੈ ਅਸੀਂ ਉੱਥੇ ਤੈਰਨ ਜਾਂਦੇ ਹਾਂ ਅਤੇ ਉਹ ਸਾਫ ਪਾਣੀ ਵੀ ਹੈ ਅਸੀਂ ਉੱਥੇ ਤੈਰਾਕੀ ਕਰਦੇ ਹਾਂ ਬਹੁਤ ਵਧੀਆ ਪਾਣੀ ਵੱਗਦਾ ਹੈ ਉਥੇ ਹੋਰ ਵੀ ਆਲੇ ਦੁਆਲੇ ਦੇ ਲੋਕ ਇਕੱਠੇ ਹੋ ਕੇ ਆਉਂਦੇ ਹਨ ਤੈਰਨ ਵਾਸਤੇ ਗਰਮੀਆਂ ਵਿੱਚ ਬਹੁਤ ਜ਼ਿਆਦਾ ਉਹ ਸੁਹਾਵਣਾ ਦ੍ਰਿਸ਼ ਬਣ ਜਾਂਦਾ ਹੈ ਜਿੱਥੇ ਅਸੀਂ ਤੈਰਨ ਜਾਂਦੇ ਹਾਂ ਉਹ ਬਹੁਤ ਹੀ ਵਧੀਆ ਜਗ੍ਹਾ ਹੈ ਇੱਕ ਸੈਰ ਸਪਾਟੇ ਵਾਲੀ ਜਗ੍ਹਾ ਹੈ ਅਤੇ ਕੋਈ ਗੰਦਾ ਪਾਣੀ ਵੀ ਨਹੀਂ ਹੈ ਸਾਡੇ ਨੇੜੇ ਹੈ ਇਲਾਕੇ ਦੇ ਬਹੁਤ ਜ਼ਿਆਦਾ ਵਧੀਆ ਹੈ ਉੱਥੇ ਅਸੀਂ ਹਰ ਰੋਜ਼ ਗਰਮੀਆਂ ਵਿੱਚ ਤੈਰਨ ਜਾਂਦੇ ਹਾਂ ਅਤੇ ਬਹੁਤ ਵਧੀਆ ਉਹ ਜਗ੍ਹਾ ਹੈ